ਗੁਡ ਈਵਨਿੰਗ ਸਰ ਸਰ ਤੁਸੀਂ ਲੁਧਿਆਣੇ ਸਟੇਸ਼ਨ ਤ ਤੋਂ ਬੋਲ ਰਹੇ ਹੋ ਹਾਂਜੀ ਸਰ ਅਤੇ ਤੁਸੀਂ ਕਹਿੰਦੇ ਮੈਨੂੰ ਪੰਜਾਬ ਦੇ ਜਿਹੜੇ ਲੁਧਿਆਣੇ ਤੋਂ ਲੱਗਦੇ ਹੈ ਸਟੇਸ਼ਨ ਸਿਟੀਜ਼ ਉਹਨਾਂ ਦੇ ਬਾਰੇ ਕੁਝ ਜਾਣਕਾਰੀ ਹੈ ਨਹੀਂ ਕੀ ਤੁਸੀਂ ਮੈਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰ ਸਕਦੇ ਹੋ ਹਾਂਜੀ ਸਰ ਮੈਨੂੰ ਤਾਂ ਐਕਚੁਲੀ ਪਹਿਲਾਂ ਦੱਸ ਦਿਓ ਕਿ ਲੁਧਿਆਣੇ ਤੋਂ ਕਿਹੜੀ ਕਿਹੜੀ ਸਿਟੀਜ਼ ਦੇ ਵਿੱਚ ਮੈਂ ਜਾ ਸਕਦੀ ਹਾਂ ਨਜ਼ਦੀਕ ਜਿਹੜੀ ਹੋਣ ਹਾਂਜੀ ਹਾਂਜੀ ਨਹੀਂ ਸਰ ਮੈਂ ਪਹਿਲੀ ਵਾਰੀ ਆਈ ਹਾਂ ਸਰ ਇੱਥੇ ਅਤੇ ਕਹਿੰਦੇ ਹਾਂਜੀ ਸਰ ਲੁਧਿਆਣੇ ਹਾਂਜੀ ਲੁਧਿਆਣੇ ਫਸਟ ਟਾਈਮ ਆਈ ਹਾਂ ਸਰ ਅੱਛਾ ਮੈਮ ਓਕੇ ਸਰ ਸਰ ਉਹ ਵੀ ਮੈਨੂੰ ਲੁਧਿਆਣੇ ਤੋਂ ਹੀ ਮਿਲੂਗੀ ਸਰ ਪਲੈਟਫਾਰਮ ਵਗੈਰਾ ਦੀ ਡਿਟੇਲ ਮਿਲ ਜੂਗੀ ਸਰ ਪਹਿਲਾਂ ਤਾਂ ਮੈਂ ਅੰਮ੍ਰਿਤਸਰ ਹੀ ਜਾਣਾ ਚਾਹੁੰਦੀ ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਗੋਲਡਨ ਟੈਂਪਲ ਤਾਂ ਕਰਕੇ ਨਜ਼ਦੀਕ ਹੈ ਸਰ ਲੁਧਿਆਣੇ ਤੋਂ ਨਹੀਂ ਸਰ ਕਿੱਡੀ ਕਿੱਡੇ ਘੰਟੇ ਕਿੰਨੇ ਘੰਟੇ ਦਾ ਮਤਲਬ ਸਫ਼ਰ ਹੋਵੇਗਾ ਹਿਮਾਚਲ ਵੱਲ ਅੱਛਾ ਸਰ ਅੱਛਾ ਸਰ ਸਰ ਮਤਲਬ ਲੁਧਿਆਣੇ ਤੋਂ ਸਭ ਤੋਂ ਪਹਿਲਾਂ ਜਿਹੜਾ ਆਸਾਨ ਸਫ਼ਰ ਮੈਨੂੰ ਅੰਮ੍ਰਿਤਸਰ ਦਾ ਹੀ ਹੋਵੇਗਾ ਅਤੇ ਫਿਰ ਮੈਂ ਅੰਮ੍ਰਿਤਸਰ ਹੀ ਫਿਰ ਚੂਜ਼ ਕਰਨਾ ਚਾਹੂੰਗੀ ਅਤੇ ਸਰ ਕਿਹੜੀ ਕਿਹੜੀ ਆਪਾਂ ਨੂੰ ਸਟੇਸ਼ਨ ਤੋਂ ਗੱਡੀ ਮਿਲੂਗੀ ਸਰ ਉਹ ਵੀ ਮੈਨੂੰ ਦੱਸ ਦਿਓ

ਸਰ ਛੇ ਨੰਬਰ ਪਲੈਟਫੋਰਮ ਤੋਂ ਸਰ ਛੇ ਨੰਬਰ ਪਲੈਟਫੋਰਮ ਤੋਂ ਅੱਛਾ ਸਰ ਠੀਕ ਹੈ ਇਹ ਹੀ ਕੰਨਫਿਊਜ਼ਨ ਸੀ ਜ਼ਿਆਦਾ ਮੈਨੂੰ ਠੀਕ ਹੈ ਸਰ ਮੈਂ ਨੋਟ ਕਰ ਲਿਆ ਪਲੈਟਫੋਮ ਨੰਬਰ ਦੋ ਅਤੇ ਗੱਡੀ ਦਾ ਨੰਬਰ ਮੈਂ ਨੋਟ ਕਰ ਲਿਆ ਸਰ ਹਾਂਜੀ ਸਰ ਇਹਦਾ ਫੇਅਰ ਕਿੰਨਾ ਹੋਵੇਗਾ ਸਰ ਓਕੇ ਸਰ ਅੱਛਾ ਸਰ ਮੈਨੂੰ ਰਿਜ਼ਰਵੇਸ਼ਨ ਦੇ ਵਿੱਚ ਟਿਕਟ ਮਿਲ ਜੂਗੀ ਸਰ ਅੱਛਾ ਸਰ ਵੈਸੇ ਜ਼ਿਆਦਾ ਭੀੜ ਭਾੜ ਤਾਂ ਨਹੀਂ ਹੁੰਦੀ ਹੋਵੇਗੀ ਸਰ ਕਿਉਂਕਿ ਡੇਲੀ ਦਾ ਹੋਵੇਗਾ ਠੀਕ ਹੈ ਸਰ ਮੈਂ ਆਪਣੇ ਸਰ ਹੁਣ ਮੈਨੂੰ ਜਿੰਨੀ ਜਾਣਕਾਰੀ ਚਾਹੀਦੀ ਹੈ ਮੈਂ ਓਨੀ ਲਊਂਗੀ ਸਰ ਤੁਹਾਡੇ ਤੋਂ ਹਾਂਜੀ ਸਰ ਸਰ ਥੈਂਕ ਯੂ ਸਰ ਇੰਨੇ ਲਈ ਠੀਕ ਹੈ ਸਰ